ਹਾਂਜੀ ਜਿਵੇਂ ਕਿਸੇ ਨੇ ਕਿਹਾ ਹੈ ਕਿ ਜਲ ਹੀ ਜੀਵਨ ਹੈ ਜਦੋਂ ਪਾਣੀ ਸਵੇਰ ਤੋਂ ਅਸੀਂ ਸੈਰ ਸਪਾਟੇ ਲਈ ਜਾਂਦੇ ਹਾਂ ਉੱਥੇ ਯੋਗਾ ਵਗੈਰਾ ਕਰਨ ਤੋਂ ਬਾਅਦ ਥਕਾਵਟ ਹੁੰਦੀ ਹੈ ਤਾਂ ਪਾਣੀ ਪੀਣ ਦੀ ਲੋੜ ਪੈਂਦੀ ਹੈ ਉਸ ਤੋਂ ਬਾਅਦ ਅਸੀਂ ਭੋਜਨ ਬਣਾਉਂਦੇ ਹਾਂ ਤਦ ਵੀ ਰਸੋਈ ਵਿੱਚ ਦਾਲ਼ ਸਬਜ਼ੀ ਬਣਾਉਣ ਲਈ ਉਦੋਂ ਪਾਣੀ ਦੀ ਲੋੜ ਪੈਂਦੀ ਹੈ ਆਪਾਂ ਸਬਜ਼ੀਆਂ ਨੂੰ ਵਾਸ਼ ਕਰਨਾ ਹੈ ਪਕਾਉਣਾ ਹੈ ਰੋਟੀ ਬਣਾਉਣੀ ਹੈ ਅਤੇ ਭੋ ਭੋਜਨ ਨੂੰ ਪਕਾਉਣ ਸਮੇਂ ਅਤੇ ਉਹਨੂੰ ਧੋਣ ਸਮੇਂ ਰੋਟ ਹੈ ਨਾ ਪਾਣੀ ਦੀ ਲੋੜ ਪੈਂਦੀ ਹੈ ਘਰ ਦੀ ਸਾਫ ਸਫਾਈ ਕਰਨ ਲਈ ਵੀ ਪਾਣੀ ਦੀ ਜ਼ਰੂਰਤ ਪੈਂਦੀ ਹੈ ਅਤੇ ਆਪਣੇ ਆਲ਼ੇ ਦੁਆਲ਼ੇ ਨੂੰ ਸਾਫ ਰੱਖਣ ਲਈ ਵੀ ਪਾਣੀ ਦੀ ਲੋੜ ਪੈਂਦੀ ਹੈ ਜਦੋਂ ਕੱਪੜੇ ਧੋਣੇ ਹਨ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸਫਾਈ ਕਰਨ ਲਈ ਉਦੋਂ ਵੀ ਪਾਣੀ ਦੀ ਜ਼ਰੂਰਤ ਪੈਂਦੀ ਹੈ ਅਤੇ ਆਪਾਂ